ਡਾਕਟਰ ਸਾਹਿਬ ਬੋਲਦੇ ਜੀ ਡਾਕਟਰ ਸਾਹਿਬ ਮੇਰੇ ਨਾ ਇੱਦਾਂ ਪੈਰ 'ਤੇ ਸੱਟ ਲੱਗ ਗਈ ਹੈ ਐਕਸੀਡੈਂਟ ਹੋ ਗਿਆ ਮੇਰੇ ਅਤੇ ਮੈਂ ਤੁਹਾਨੂੰ ਮਿਲਣਾ ਚਾਹੁੰਨਾ ਹਾਂ ਦਿਖਾਉਣਾ ਚਾਹੁੰਨਾ ਹਾਂ ਇਲਾਜ ਕਰਾਉਣਾ ਚਾਹੁੰਦਾ ਹਾਂ ਤੁਹਾਡੇ ਤੋਂ ਹਾਂਜੀ ਅਤੇ ਕੀ ਜਦੋਂ ਤੁਸੀਂ ਮਿਲ ਸਕਦੇ ਜੀ ਹਾਂਜੀ

ਹਾਂਜੀ ਹਾਂਜੀ ਹਾਂਜੀ ਮੈਡਮ ਕੋਈ ਨਹੀਂ ਉਹ ਤਾਂ ਠੀਕ ਹੈ ਮੈਡਮ ਅਤੇ ਫਿਲਹਾਲ ਹੁਣ ਜਿੱਦਾਂ ਬਲੱਡ ਵਗਦਾ ਵਾ ਅਤੇ ਆਪਾਂ ਕਿਸੇ ਤੋਂ ਹੁਣ ਟ੍ਰੀਟਮੈਂਟ ਕਰਾ ਸਕਦੇ ਕਿਸੇ ਤੋਂ ਲੋਕਲ ਡਾਕਟਰ ਕੋਲੋਂ ਹਾਂਜੀ ਅੱਛਾ ਜੀ ਅਤੇ ਮੈਡਮ ਤੇ ਦਰਦ ਦਰਦ ਹੋ ਰਹੀ ਹੈ ਦਰਦ ਦਾ ਕੀ ਕਰ ਸਕਦੇ ਆਪਾਂ ਇਲਾਜ ਅੱਛਾ ਅੱਛਾ ਹਾਂਜੀ ਐਂਟੀਬੈਟਿਕ ਵੀ ਲੈ ਲਈਏ ਚਲੋ ਠੀਕ ਹੈ ਮੈਡਮ ਠੀਕ ਆ